ਹਾਂ ਮੈਂ ਸੋਚਦਾ ਹਾਂ ਕਿ ਸਕੂਲ ਦੇ ਸਿਲੇਬਸ ਵਿੱਚ ਬੈਂਕ ਦੇ ਜਿੰਨੀਆਂ ਵੀ ਨੀਤੀਆਂ ਹਨ ਉਨ੍ਹਾਂ ਬਾਰੇ ਪੜ੍ਹਾਇਆ ਜਾਣਾ ਚਾਹੀਦਾ ਹੈ ਜਿਵੇਂ ਕਿ ਕਰਜ਼ੇ ਦੇ ਉੱਪਰ ਕਿੰਨਾ ਵਿਆਜ ਲੱਗਦਾ ਹੈ ਕਰਜ਼ੇ ਕਿਸ ਪ੍ਰਕਾਰ ਲਏ ਜਾਂਦੇ ਹਨ ਕਿੰਨਾ ਉਨ੍ਹਾਂ ਦਾ ਈ ਐੱਮ ਆਈ ਭਰੀ ਜਾਂਦੀ ਹੈ ਉਹ ਤੋਂ ਬਾਅਦ ਅਗਰ ਇਸ ਤਰੀਕੇ ਦਾ ਹੋ ਜਾਂਦਾ ਹੈ ਤਾਂ ਇੱਕ ਨਵੇਂ ਬੱਚੇ ਨੂੰ ਪੂਰਾ ਇਹਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਉਹਨੂੰ ਕੋਈ ਮੁਸ਼ਕਲ ਨਹੀਂ ਆਵੇਗੀ ਜਿੰਨੇ ਵੀ ਕੋਮਰਸ ਦੇ ਸਟੂਡੈਂਟ ਹਨ ਉਨ੍ਹਾਂ ਦੇ ਨਾਲ ਨਾਲ ਨੌਨ ਮੈਡੀਕਲ ਜਾਂ ਬਾਕੀ ਸਬਜੈਕਟ ਪੜ੍ਹਨ ਵਾਲਿਆਂ ਨੂੰ ਵੀ ਇਹਦੇ ਬਾਰੇ ਜਾਣਕਾਰੀ ਹੋਣੀ ਜ਼ਰੂਰੀ ਹੈ ਕਈ ਪ੍ਰਕਾਰ ਦੀਆਂ ਬੈਂਕ ਦੇ ਵਿੱਚ ਪੋਲਸੀਆਂ ਹੁੰਦੀਆਂ ਹਨ ਜਿਹਦੇ ਬਾਰੇ ਆਮ ਲੋਕਾਂ ਨੂੰ ਨਹੀਂ ਪਤਾ ਹੁੰਦਾ ਜਿਸ ਦੇ ਵਿੱਚ ਅਸੀਂ ਵੀ ਸ਼ਾਮਲ ਹਾਂ ਇਨ੍ਹਾਂ ਬਾਰੇ ਪਤਾ ਹੋਣਾ ਜ਼ਰੂਰੀ ਹੈ ਹੋਮ ਲੋਨ ਦੇ ਉੱਪਰ ਕਿੰਨਾ ਇੰਟਰਸਟ ਲੱਗਦਾ ਪਰਸਨਲ ਲੋਨ ਦੇ ਉੱਪਰ ਕਿੰਨਾ ਇੰਟਰਸਟ ਲੱਗਦਾ ਇਹਦੇ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਇਸ ਤਰੀਕੇ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਜਿਵੇਂ ਕਿ ਇੱਕ ਬੈਂਕ ਇਮਪਲਾਈ ਨੂੰ ਹੁੰਦੀ ਹੈ ਉਸੇ ਪ੍ਰਕਾਰ ਦੀ ਇੱਕ ਸਟੂਡੈਂਟ ਨੂੰ ਹੋਣ ਨਾਲ ਇਸ ਦੇਸ਼ ਦੇ ਵਿੱਚ ਬਹੁਤ ਜ਼ਿਆਦਾ ਫਾਇਦਾ ਹੋ ਜੂਗਾ ਜਦੋਂ ਇਸ ਪਰੀ ਤਰੀਕੇ ਦੀ ਜਾਣਕਾਰੀ ਪ੍ਰਾਪਤ ਕਰ ਲਵੇਗਾ ਤਾਂ ਉਸ ਨੂੰ ਟੈਕਸ ਭਰਨ ਦੇ ਵਿੱਚ ਵੀ ਕੋਈ ਦਿੱਕਤ ਨਹੀਂ ਆਵੇਗੀ ਅਗਰ ਟੈਕਸ ਅਸੀਂ ਭਰ ਦਿੰਦੇ ਹਾਂ ਤਾਂ ਉਸ ਦੇ ਨਾਲ ਦੇਸ਼ ਦੀ ਉੱਨਤੀ ਹੁੰਦੀ ਹੈ ਨਹੀਂ ਤਾਂ ਕਈ ਟੈਕਸ ਨੂੰ ਛੁਪਾ ਵੀ ਲੈਂਦੇ ਹੈ ਅਤੇ ਉਹਦੇ ਬਾਰੇ ਜਦੋਂ ਜਾਣਕਾਰੀ ਮਿਲ ਜਾਊਂਗੀ ਤਾਂ ਉਹ ਬੰਦਾ ਟੈਕਸ ਭਰੇਗਾ ਜਿਸ ਦੇ ਨਾਲ ਦੇਸ਼ ਦੀ ਉੱਨਤੀ ਹੋਵੇਗੀ